ਮੈਨੂੰ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਕਾਫੀ ਸ਼ੌਕ ਸੀ ਅਤੇ ਮੇਰੇ ਇਸ ਖਾਣਾ ਬਣਾਉਣ ਦੇ ਸ਼ੌਕ ਨੂੰ ਮੇਰੀ ਮਾਤਾ ਜੀ ਨੇ ਕਾਫੀ ਪ੍ਰੋਤਸਾਹਿਤ ਕੀਤਾ ਅਤੇ ਉਹ ਮੈਨੂੰ ਖਾਣਾ ਬਣਾਉਣ ਵੇਲੇ ਕਾਫੀ ਹੱਲਾਸ਼ੇਰੀ ਦਿੰਦੇ ਸਨ ਅਤੇ ਕਾਫੀ ਸਾਰੀਆਂ ਕਾਫੀ ਸਾਰਾ ਭੋਜਨ ਮੈਂ ਆਪਣੀ ਮਾਤਾ ਜੀ ਤੋਂ ਹੀ ਬਣਾਉਣਾ ਸਿੱਖਿਆ ਮੈਂ ਜਦੋਂ ਵੀ ਕੋਈ ਨਵਾਂ ਵਿਅੰਜਨ ਜਾਂ ਕੋਈ ਨਵੀਂ ਰੈਸਪੀ ਟਰਾਈ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੇਰੇ ਮਾਤਾ ਜੀ ਉਸ ਵਿੱਚ ਪੂਰਾ ਯੋਗਦਾਨ ਦਿੰਦੇ ਸਨ ਅਤੇ ਮੇਰੀ ਮਦਦ ਕਰਦੇ ਸਨ ਅਤੇ ਮੇਰੇ ਮਾਤਾ ਜੀ ਨੂੰ ਅਤੇ ਮੇਰੇ ਮਾਤਾ ਜੀ ਨੂੰ ਕਾਫੀ ਤਰੀਕੇ ਦਾ ਭੋਜਨ ਬਣਾਉਣਾ ਆਉਂਦਾ ਹੈ ਜਿਵੇਂ ਕਿ ਇਟਾਲੀਅਨ ਚਾਈਨੀਜ਼ ਉਹ ਹੈ ਸਭ ਭੋਜਨ ਬਣਾਉਣਾ ਵੀ ਜਾਣਦੇ ਸਨ ਅਤੇ ਮੇਰੇ ਇਸ ਖਾਣਾ ਬਣਾਉਣ ਦੇ ਸ਼ੌਕ ਨੂੰ ਲੈ ਕੇ ਮੇਰਾ ਪਰਿਵਾਰ ਬਹੁਤ ਖੁਸ਼ ਹੈ ਅਤੇ ਮੈਂ ਜਦੋਂ ਵੀ ਕੋਈ ਵਿਅੰਜਨ ਆਪਣੇ ਮਾਤਾ ਜੀ ਦੇ ਦੱਸੇ ਹੋਏ ਤਰੀਕੇ ਨਾਲ ਬਣਾਉਂਦੀ ਸਾਂ ਤਾਂ ਮੇਰਾ ਸਾਰਾ ਪਰਿਵਾਰ ਹੀ ਬਹੁਤ ਖੁਸ਼ ਹੋ ਕੇ ਖਾਂਦਾ ਹੈ ਅਤੇ ਹੁਣ ਮੇਰਾ ਪਰਿਵਾਰ ਮੈਨੂੰ ਇਹੀ ਸਲਾਹ ਦਿੰਦਾ ਹੈ ਮਸ਼ਵਰਾ ਦਿੰਦਾ ਹੈ ਕਿ ਤੂੰ ਜਦੋਂ ਵੱਡੀ ਹੋ ਜਾਵੇਗੀ ਤਾਂ ਤੂੰ ਆਪਣਾ ਕੋਈ ਕੂਕਿੰਗ ਇੰਸਟੀਟਿਊਡ ਜਾਂ ਕੂਕਿੰਗ ਕਲਾਸਿਸ ਜੁਆਇਨ ਕਰਕੇ ਅਤੇ ਆਪਣੇ ਇਸ ਸ਼ੌਕ ਨੂੰ ਵਧਾ ਕੇ ਕੋਈ ਰੁਜ਼ਗਾਰ ਦਾ ਸਾਧਨ ਬਣਾ ਸਕਦੀ ਹਾਂ ਤੇਰਾ ਸ਼ੌਕ ਵੀ ਪੂਰਾ ਹੋ ਜਾਵੇਗਾ ਅਤੇ ਤੇਰਾ ਰੁਜ਼ਗਾਰ ਦਾ ਸਾਧਨ ਵੀ ਬਣ ਜਾਵੇਗਾ